ਮੇਰੇ ਕੋਲ ਲਓਇਡ ਕੰਪਨੀ ਦੀ ਐੱਲ ਈ ਡੀ ਹੈ ਅਤੇ ਦੀਵਾਲੀ ਵਾਲੇ ਦਿਨ ਆਫਰ ਚੱਲ ਰਹੀ ਸੀ ਅਤੇ ਦੁਕਾਨਦਾਰ ਭਾਅ ਜੀ ਆਵਾਜ਼ ਦੇ ਰਹੇ ਸੀਗੇ ਬੀ ਲੈ ਲਓ ਐੱਲ ਈ ਡੀ ਸਸਤੇ ਰੇਟ ਪਰ ਆ ਬੱਤੀ ਇੰਚੀ ਦੀ ਐੱਲ ਈ ਡੀ ਮੈਂ ਪੁੱਛਿਆ ਉਨ੍ਹਾਂ ਨੂੰ ਕਹਿੰਦੇ ਦਸ ਹਜ਼ਾਰ ਰੁਪਏ ਦੀ ਹੈ ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਭਾਅ ਜੀ ਕਿੱਦਾਂ ਚੱਲਦੀ ਹੈ ਵਧੀਆ ਚਲਦੀ ਹੈ ਉਹ ਕਹਿੰਦੇ ਇਹ ਪੰਦਰਾਂ ਵੀਹ ਲੋਕ ਹੁਣੇ ਲੈ ਕੇ ਗਏ ਹੈ ਬਹੁਤ ਵਧੀਆ ਚੱਲਦੀ ਹੈ ਉਹਨਾਂ ਕੋਲ ਅਤੇ ਕੋਈ ਦਿੱਕਤ ਬਾਜ਼ੀ ਨਹੀਂ ਆਉਂਦੀ ਹੈਗੀ ਤਾਂ ਸਹੀ ਚੱਲ ਰਹੀ ਹਾਂ ਅਤੇ ਮੇਰੇ ਕੋਲ ਮੈਂ ਲੈ ਕੇ ਆਇਆ ਵੀਹ ਬਾਈ ਦਿਨ ਮਸੀਂ ਚੱਲੀ ਹੈ ਮੀਂਹ ਆਇਆ ਬਿਜਲੀ ਲਸ਼ਕੀ ਅਤੇ ਖਰਾਬ ਹੋ ਗਈ ਇਹ ਐੱਲ ਈ ਡੀ ਤਾਂ ਮੈਂ ਕੰਪਨੀ ਵਾਲਿਆਂ ਨੂੰ ਫੋਨ ਕੀਤਾ ਤਾਂ ਉਹ ਘਰ ਆਏ ਠੀਕ ਕਰਕੇ ਗਏ ਤਾਂ ਐੱਲ ਈ ਡੀ ਠੀਕ ਹੋਈ ਦਸ ਕੁ ਦਿਨ ਚੱਲੀ ਉਸ ਤੋਂ ਬਾਅਦ ਫੇਰ ਖਰਾਬ ਹੋ ਗਈ ਤਾਂ ਮੈਂ ਹਰ ਇੱਕ ਨੂੰ ਇਹੀ ਸਲਾਹ ਦਉਂਗਾ ਜਦ ਵੀ ਕੋਈ ਆਫਰ ਚੱਲਦੀ ਹੋਵੇ ਜਾਂ ਦੁਕਾਨਦਾਰ ਕਹੇ ਆ ਸਸਤੇ ਰੇਟ ਪਰ ਆ ਵਧੀਆ ਮਿੱਲ ਚੱਲਦੀ ਹਾਂ ਇਹ ਐੱਲ ਈ ਡੀ ਤਾਂ ਕਦੇ ਲਵੋ ਨਾ